ਜੇ ਗੱਲ ਭਾਰਤ ਦੀ ਅੱਜ ਦਾ ਅੱਜ ਦਾ ਦੌਰ ਕੁਝ ਹੋਰ ਹੈ ਪੁਰਾਣਾ ਦੌਰ ਕੁਝ ਹੋਰ ਸੀ ਪੁਰਾਣੇ ਦੌਰ ਵਿੱਚ ਨਾ ਕੋਈ ਸਮਾਰਟ ਫੋਨ ਨਾ ਕੋਈ ਫੋਨ ਟੈਲੀਫੋਨ ਛੋਟੇ ਵੱਡੇ ਕੋਈ ਫੋਨ ਨਾ ਨਹੀਂ ਸੀਗੇ ਪਰ ਅੱਜ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਜ਼ਿਆਦਾ ਹੌਲੀ ਹੌਲੀ ਪੰਜਾਬ ਭਾਰਤ ਵਿਕਾਸ ਕਰ ਰਿਹਾ ਹੈ ਅਤੇ ਨਵੀਂ ਨਵੀਂ ਟੈਕਨੋਲਜੀ ਆ ਗਈਆਂ ਹਨ ਵਾਹਨ ਆ ਗਏ ਹਨ ਮੋਟਰਸਾਈਕਲ ਗੱਡੀਆਂ ਸਕੂਟਰ ਆਦਿ ਐੱਲ ਸੀ ਡੀ ਆ ਗਈਆਂ ਹਨ ਸਮਾਟ ਸਮਾਟ ਫੋਨ ਆ ਗਏ ਸਮਾਟ ਵੌਚ ਆ ਗਈ ਅਗਰ ਗੱਲ ਕੀਤੀ ਜਾਵੇ ਵੱਡੇ ਵੱਡੇ ਵਪਾਰੀਆਂ ਦੀ ਉਦਯੋਗਪਤੀਆਂ ਦੀ ਉਹਨਾਂ ਵਿੱਚ ਨਾਮ ਹੈਗਾ ਅੰਬਾਨੀ ਰਤਨ ਟਾਟਾ ਜੋ ਕਿ ਰਤਨ ਟਾਟਾ ਵਿੱਚ ਬਹੁਤ ਹੀ ਜ਼ਿਆਦਾ ਚੈਰਿਟੀ ਕਰਦੇ ਹਨ ਲੋਕਾਂ ਦੀ ਮਦਦ ਕਰਦੇ ਹਨ ਅਗਰ ਗੱਲ ਕੀਤੀ ਜਾਵੇ ਅੰਬਾਨੀ ਦੀ ਉਹਦੇ ਬਹੁਤ ਵੱਡੇ ਵੱਡੇ ਬਿਜਨਸ ਹਨ ਜੀਓ ਉਹਦੀ ਕੰਪਨੀ ਆ ਰਿਲਾਇੰਸ ਉਹਦੇ ਮੋਲ ਹੈ ਬਹੁਤ ਵੱਡੀਆਂ ਵੱਡੀਆਂ ਉਹਦੀਆਂ ਕ ਕੰਪਨੀਆਂ ਹਨ